ਹਾਂਜੀ ਮੇਰਾ ਸੋਚਣਾ ਇਹ ਕਿ ਬੱਚਿਆਂ ਦੇ ਸਕੂਲ ਵਿੱਚ ਕਰਜ਼ੇ ਅਤੇ ਰਿਟਰਨਾਂ ਬਾਰੇ ਦੱਸਣਾ ਜਾਂ ਪੜ੍ਹਾਉਣਾ ਬਹੁਤ ਹੀ ਜ਼ਰੂਰੀ ਹੈ ਇਹਨਾਂ ਨੂੰ ਆਪਣੇ ਅਧਿਆਇ ਦੇ ਵਿੱਚ ਜਾਂ ਸਿਲੇਬਸ ਦੇ ਵਿੱਚ ਇਸਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਇਹ ਕਾਫੀ ਲਾਭਕਾਰੀ ਹੋਏਗਾ ਜਿਸ ਨਾਲ ਬੱਚਿਆਂ ਨੂੰ ਗਿਆਨ ਦੇ ਵਿੱਚ ਵੀ ਵਾਧਾ ਹੋਏਗਾ ਉਹਨਾਂ ਨੂੰ ਕਾਫੀ ਕੁਝ ਪਤਾ ਲੱਗੇਗਾ ਕਿ ਦੇਸ਼ ਦੇ ਵਿੱਚ ਇਹ ਕੁਝ ਕਰਜ਼ਿਆਂ ਅਤੇ ਰਿਟਰਨਾਂ ਦਾ ਵੀ ਕੀ ਭੂਮਿਕਾ ਹੈ ਤੁਸੀਂ ਅੱਜ ਕੱਲ੍ਹ ਦੇਖ ਹੀ ਰਹੇ ਹੋ ਕਿ ਕਿਸਾਨ ਅੰਦੋਲਨ ਹੋ ਰਹੇ ਹਨ ਕਿਉਂਕਿ ਕਈ ਬੱਚਿਆਂ ਨੂੰ ਕੁਝ ਪਤਾ ਹੀ ਨਹੀਂ ਹੈ ਕਿ ਇਹ ਅੰਦੋਲਨ ਕਿਸ ਚੀਜ਼ ਉੱਤੇ ਆ ਅਤੇ ਕਿਉਂ ਹੋ ਰਹੇ ਆ ਇਸ ਕਰਕੇ ਹੋਰ ਕਈ ਵੀ ਕਾਰਨ ਹਨ ਜਿਵੇਂ ਕੁਝ ਮਾਂ ਪਿਓ ਆਪਣੇ ਬੱਚਿਆਂ ਨੂੰ ਬਾਹਰਲੇ ਦੇਸ਼ਾਂ ਵਿੱਚ ਭੇਜਣ ਲਈ ਕਰਜ਼ੇ ਚੁੱਕਦੇ ਆ ਜਿਹਨਾਂ ਬਾਰੇ ਬੱਚਿਆਂ ਨੂੰ ਕੁਛ ਪਤਾ ਹੀ ਨਹੀਂ ਹੁੰਦਾ ਸਾਨੂੰ ਆਪਣੇ ਖਾਤਿਆਂ ਲਈ ਵੀ ਰਿਟਰਨਾਂ ਭਰਨੀਆਂ ਪੈਂਦੀਆਂ ਹਨ ਇਹਨਾਂ ਦਾ ਵੀ ਸਾਨੂੰ ਪਹਿਲਾਂ ਕੁਝ ਨਹੀਂ ਸੀ ਪਤਾ ਹੁੰਦਾ ਬਾਅਦ ਵਿੱਚ ਹੀ ਪਤਾ ਚੱਲਦਾ ਹੈ ਇਸ ਕਰਕੇ ਬੱਚਿਆਂ ਦੇ ਸਕੂਲਾਂ ਦੇ ਵਿੱਚ ਇਹਨਾਂ ਅਧਿਆਇਆਂ ਨੂੰ ਪੜ੍ਹਾਇਆ ਜਾਣਾ ਬਹੁਤ ਹੀ ਜ਼ਰੂਰੀ ਹੈ ਉਹਨਾਂ ਦੀ ਜਾਨਕ ਇਸ ਚੀਜ਼ ਦੀ ਜਾਣਕਾਰੀ ਉਹਨਾਂ ਲਈ ਕਾਫੀ ਜ਼ਿਆਦਾ ਲਾਭਕਾਰੀ ਹੋਵੇਗੀ ਸਾਨੂੰ ਆਪਣੇ ਜੀਵਨ ਉਹਨਾਂ ਨੂੰ ਵੀ ਅਤੇ ਸਾਨੂੰ ਵੀ ਆਪਣੇ ਜੀ ਜੀਵਨ ਵਿੱਚ ਸਹੀ ਤਰੀਕੇ ਦੇ ਨਾਲ ਚੱਲਣਾ ਆ ਜਾਵੇਗਾ ਆਪਣੇ ਮਾਪਿਆਂ ਨੂੰ ਵੀ ਸਮਝਣਗੇ ਅਤੇ ਉਹ ਕੀ ਉਹਨਾਂ ਲਈ ਇਹ ਕੀ ਕੁਝ ਕਰਦੇ ਆ ਇਸ ਲਈ ਸਿਲੇਬਸ ਦੇ ਵਿੱਚ ਇਸ ਨੂੰ ਸ਼ਾਮਿਲ ਕਰਨਾ ਬਹੁਤ ਹੀ ਜ਼ਿਆਦਾ ਲਾਭਕਾਰੀ ਹੋਏਗਾ